ਪੰਜਾਬੀ ਭਾਸ਼ਾ ਸ਼ੁਰੂ ਤੋਂ ਹੀ ਬਹੁਤ ਸਾਰੀਆਂ ਭਾਸ਼ਾਵਾਂ ਤੋਂ ਪ੍ਰਭਾਵਿਤ ਹੁੰਦੀ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਅੰਗਰੇਜ਼ ਆਏ ਉਹਨਾਂ ਦੇ ਆਉਣ ਦੇ ਨਾਲ ਆਪਣੇ ਪੰਜਾਬੀ ਭਾਸ਼ਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਕਿਉਂਕਿ ਉਹਨਾਂ ਦੇ ਰਾਜ ਦੇ ਦੌਰਾਨ ਅੰਗਰੇਜ਼ੀ ਦੇ ਸ਼ਬਦ ਪੰਜਾਬੀ ਭਾਸ਼ਾ ਵਿੱਚ ਮਿਕਸ ਹੋਣ ਲੱਗੇ ਅਤੇ ਆਪਣੇ ਲੋਕਾਂ ਨੇ ਵੀ ਉਹਨਾਂ ਭਾਸ਼ਾ ਨੂੰ ਆਪਣੀ ਭਾਸ਼ਾ ਦੇ ਵਿੱਚ ਤਬਦੀਲ ਕੀਤਾ ਬਹੁਤ ਸਾਰੇ ਸ਼ਬਦਾਂ ਨੂੰ ਪੰਜਾਬੀ ਭਾਸ਼ਾ ਵਿੱਚ ਲੈ ਕੇ ਆਂਦਾ ਇਸਦੇ ਨਾਲ ਪੰਜਾਬੀ ਭਾਸ਼ਾ ਕੀ ਹੈ ਅੰਗਰੇਜ਼ੀ ਭਾਸ਼ਾ ਤੋਂ ਬਹੁਤ ਪ੍ਰਭਾਵਿਤ ਹੋਈ ਸਭ ਤੋਂ ਜ਼ਿਆਦਾ ਪੰਜਾਬੀ ਭਾਸ਼ਾ ਸੰਸਕ੍ਰਿਤ ਭਾਸ਼ਾ ਤੋਂ ਪ੍ਰਭਾਵਿਤ ਹੋਈ ਕਿਉਂਕਿ ਜਿਹੜੀ ਸੰਸਕ੍ਰਿਤ ਦੀ ਭਾਸ਼ਾ ਹੈ ਉਹ ਸਾਰੀਆਂ ਭਾਸ਼ਾਵਾਂ ਦੀ ਮਾਂ ਮੰਨੀ ਜਾਂਦੀ ਹੈ ਸੰਸਕ੍ਰਿਤ ਦੇ ਬਹੁਤ ਸਾਰੇ ਸ਼ਬਦਾਂ ਨੂੰ ਅੰਗਰੇ ਪੰਜਾਬੀ ਦੇ ਵਿੱਚ ਵਰਤੋਂ ਵਿੱਚ ਲਿਆਂਦਾ ਗਿਆ ਉਸ ਦਾ ਕਾਰਨ ਸਾਡੇ ਬਹੁਤ ਸਾਰੇ ਕਵੀ ਕਵਿਤਰੀਆਂ ਜਿਹਨਾਂ ਦੇ ਆਪਣੇ ਸੰਗ੍ਰਿਹਾਂ ਦੇ ਵਿੱਚ ਆਪਣੀਆਂ ਕਵਿਤਾਵਾਂ ਦੇ ਵਿੱਚ ਆਪਣੀਆਂ ਗਜ਼ਲਾਂ ਦੇ ਵਿੱਚ ਸੰਸਕ੍ਰਿਤ ਦੇ ਸ਼ਬਦਾਂ ਨੂੰ ਤਰਜੀਹ ਦਿੱਤੀ ਇਸ ਦੇ ਨਾਲ ਸੰਸਕ੍ਰਿਤ ਭਾਸ਼ਾ ਪੰਜਾਬੀ ਦੇ ਵਿੱਚ ਵਰਤੀ ਜਾਣ ਲੱਗੀ ਬਹੁਤ ਸਾਰੇ ਸ਼ਬਦ ਸੰਸਕ੍ਰਿਤ ਦੇ ਪੰਜਾਬੀ ਵਿੱਚ ਵਰਤੇ ਜਾਣ ਲੱਗੇ ਇਸ ਦੇ ਨਾਲ ਪੰਜਾਬੀ ਭਾਸ਼ਾ ਸੰਸਕ੍ਰਿਤ ਤੋਂ ਵੀ ਬਹੁਤ ਪ੍ਰਭਾਵਿਤ ਹੋਈ ਪੰਜਾਬੀ ਭਾਸ਼ਾ ਬਹੁਤ ਟਾਈਮਾਂ ਤੋਂ ਬਹੁਤ ਸਾਰੀਆਂ ਭਾਸ਼ਾਵਾਂ ਤੋਂ ਪ੍ਰਭਾਵਿਤ ਹੁੰਦੀ ਆ ਰਹੀ ਹੈ ਇਸ ਕਰਕੇ ਅਸੀਂ ਅੰਤ ਵਿੱਚ ਇੰਨਾ ਕਹਿ ਸਕਦੇ ਹਾਂ ਕਿ ਇੱਕ ਪੰਜਾਬੀ ਭਾਸ਼ਾ ਜਿਹੜੀ ਬਹੁਤ ਹੀ ਵਿਲੱਖਣ ਅਤੇ ਵਿਭਿੰਨ ਭਾਸ਼ਾ ਹੈ ਜਿਸ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਨੇ ਪ੍ਰਭਾਵਿਤ ਕੀਤਾ ਹੈ